ਹੈਲੋ ਭਾਅ ਜੀ ਹਾਂਜੀ ਹਾਂਜੀ ਜ਼ੋਮੈਟੋ ਤੋਂ ਬੋਲਦੇ ਹੋ ਸਰ ਮੈਂ ਨਾ ਤੁਹਾਨੂੰ ਇੱਕ ਔਡਰ ਕੀਤਾ ਸੀ ਅਤੇ ਮੈਂ ਵੇਖਿਆ ਤੁਹਾਡੀ ਲੋਕੇਸ਼ਨ ਇੱਥੇ ਮੇਰੇ ਘਰ ਦੇ ਕੋਲ ਆਕਾਸ਼ ਹੈਮਜ਼ ਦੇ ਕੋਲ ਆ ਰਹੀ ਹੈ ਤੁਸੀਂ ਆਕਾਸ਼ ਹੈਮ ਚਲੇ ਗਏ ਹੋ ਅਤੇ ਤੁਸੀਂ ਮੈਂ ਤੁਹਾਨੂੰ ਦੱਸਣਾ ਵਾ ਕਿ ਲੈਂਡਮਾਰਕ ਦੱਸਣਾ ਵਾ ਅਤੇ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆਕਾਸ਼ ਹੈਮ ਨੂੰ ਬੋਲੋ ਵਾਪਸ ਇੱਧਰ ਮੇਨ ਰੋਡ ਵੱਲ ਹੋਵੋ ਔਰ ਮੇਨ ਰੋਡ ਤੋਂ ਤੁਸੀਂ ਇੱਧਰ ਮਿਰ ਚੌਂਕ ਆਏਗਾ ਚੌਂਕ 'ਤੇ ਤੁਸੀਂ ਦੇਖੋਗੇ ਦਸ ਸਨੈਕ ਕਰਕੇ ਦੁਕਾਨ ਹੈਗੀ ਆ ਉਹਦੇ ਨਾਲ ਅੰਦਰ ਇੱਕ ਤ੍ਰਿਕੋਣੇ ਪਾਰਕ ਵਾਲੀ ਗਲੀ ਮੁੜਦੀ ਹੈ ਉਹ ਗਲੀ ਮੁੜ ਜਾਓ ਗਲੀ ਦੇ ਅੰਦਰ ਸਿੱਧਾ ਆਈ ਜਾਣਾ ਜੇ ਅੰਦਰ ਆਓਗੇ ਤੇ ਚਾਰ ਸੌ ਤਿੰਨ ਨੰਬਰ ਘਰ ਹੈਗਾ ਜੇ ਅਤੇ ਜੇ ਨਹੀਂ ਵੀ ਤੁਹਾਨੂੰ ਘਰ ਲੱਭੇ ਤਾਂ ਇੱਕ ਮੈਂ ਤੁਹਾਨੂੰ ਹੋਰ ਨਿਸ਼ਾਨੀ ਦੇ ਦਿੰਦਾ ਘਰ ਦੇ ਸਾਹਮਣੇ ਇੱਕ ਸਾਡੇ ਔਲਟੋ ਖੜ੍ਹੀ ਹੈ ਚਿੱਟੇ ਰੰਗ ਦੀ ਜਿਹਦਾ ਨੰਬਰ ਹੈਗਾ ਪੀ ਬੀ ਜ਼ੀਰੋ ਟੂ ਸੀ ਕਿਯੂ ਅਠਾਰਾਂ ਬਵੰਜਾ ਉਹਦੇ ਸਾਹਮਣੇ ਸਾਡਾ ਘਰ ਹੈਗਾ ਹੈ ਚਾਰ ਸੌ ਤਿੰਨ ਨੰਬਰ ਕਿਉਂਕਿ ਸਰ ਜਲਦੀ ਕਰੋ ਬੜੀ ਦੇਰ ਤੋਂ ਮੈਂ ਵੇਖ ਰਿਹਾ ਤੁਸੀਂ ਇਹ ਘਰ ਟਰੈਕ ਕੀਤਾ ਤੁਸੀਂ ਮੇਰੇ ਘਰ ਦੇ ਕੋਲ ਦੀ ਕੋਲ ਹੀ ਘੁੰਮਦੇ ਪਏ ਹੋ ਤੁਹਾਨੂੰ ਜਗ੍ਹਾ ਨਹੀਂ ਮਿਲ ਰਹੀ ਅਤੇ ਮੇਰੇ ਨਾ ਹੁਣ ਜਿਹੜੇ ਮਹਿਮਾਨ ਬ ਖਾਣੇ ਵਾਸਤੇ ਬੈਠੇ ਜਿਹਨਾਂ ਨੂੰ ਮੈਂ ਖਾਣਾ ਵੇਟ ਕਰ ਰਿਹਾ ਹਾਂ ਤਾਂ ਤੁਸੀਂ ਇਸ ਤਰ੍ਹਾਂ ਕਰੋ ਜਿਸ ਵੇਲੇ ਤੁਸੀਂ ਤ੍ਰਿਕੋਣੇ ਪਾਰਕ ਵੱਲ ਆਓਗੇ ਨਾ ਤਾਂ ਮੈਨੂੰ ਨਾ ਫ਼ੋਨ ਕਰਨਾ ਫਿਰ ਮੈਂ ਇਸ ਤਰ੍ਹਾਂ ਕਰਾਂਗਾ ਮੈਂ ਥੋੜ੍ਹਾ ਕੁ ਅੱਗੇ ਪੈਦਲ ਆਈਗਾ ਅਤੇ ਤੁਹਾਨੂੰ ਮਤਲਬ ਕਿ ਫੋਲੋ ਕਰ ਲਾਂਗਾ ਉੱਥੋਂ ਅਤੇ ਤੁਸੀਂ ਹੁਣ ਕਿੱਥੇ ਹੈਗੇ ਹੋ ਇਸ ਵੇਲੇ ਇਹ ਮੇਨ ਰੋਡ 'ਤੇ ਆ ਗਏ ਹੋ ਨਾ ਅਤੇ ਇੱਧਰ ਮੁੜੋ ਹਾਂ ਦੇਖੋ ਇਹ ਕੋਲ ਦੇਖੋ ਇੱਥੇ ਦਸ਼ਥ ਸਨੈਕਸ ਨੈਲ ਹੈ ਹਾਂ ਉਹਦੇ ਨਾਲ ਅੰਦਰ ਦੇਖੋ ਮੋੜ ਮੁੜਦਾ ਪਿਆ ਮੋੜ ਮੁੜ ਜਾਓ ਮੋੜ ਮੁੜ ਜਾਓਗੇ ਤਾਂ ਅੰਦਰ ਆਇਓ ਤ੍ਰਿਕੋਣੇ ਪਾਰਕ ਵਲੋਂ ਸਿੱਧੇ ਆਈ ਜਾਣਾ ਸਿੱਧੇ ਆਈ ਜਾਣਾ ਇੱਥੇ ਗਲੀ ਸਿੱਧੀ ਜਾਈ ਜਾ ਰਹੀ ਹੈ ਹਾਂ ਜੇ ਤਾਂ ਨਹੀਂ ਵੀ ਪਤਾ ਲੱਗੇ ਤਾਂ ਮੈਂ ਤੁਹਾਨੂੰ ਬਾਹਰ ਤ੍ਰਿਕੋਣੇ ਪਾਰਕ ਕੋਲ ਆ ਕੇ ਲੈ ਲਵਾਂਗਾ ਨਹੀਂ ਸਹੀ ਚਲੋ ਤੁਸੀਂ ਉੱਥੇ ਆਓਗੇ ਚਲੋ ਫਿਰ ਤੁਸੀਂ ਆਓ ਫਿਰ ਮੋੜ 'ਤੇ ਪਹੁੰਚੋ ਅਤੇ ਮੈਂ ਤੁਹਾਨੂੰ ਨਾ ਫੋਲੋ ਕਰ ਲੈਂਦਾ ਹਾਂ ਉੱਥੋਂ ਅਤੇ ਆ ਗਏ ਹੋ ਚਲੋ ਇਹ ਦੇਖੋ ਇੱਧਰ ਮੇਰਾ ਹੱਥ ਦੇਖੋਂ ਮੈਂ ਘਰ ਦੇ ਬਾਹਰ ਹੀ ਖੜ੍ਹਾ ਜੇ ਆ ਆ ਗਿਆ ਨਜ਼ਰ ਚਲੋ ਆ ਜਾਓ ਫਟਾਫਟ ਸਰ ਆ ਜਾਓ ਆ ਜਾਓ ਫਿਰ ਫਟਾਫਟ